ਭਾਰਤ ਦੀ ਰਾਜਨੀਤੀ ਮੈਨੂੰ ਲੱਗਦੀ ਹੈ ਕਿਤੇ ਨਾ ਕਿਤੇ ਓਦਾਂ ਦੀ ਨਹੀਂ ਹੈ ਜਿੱਦਾਂ ਦੀ ਮੈਂ ਸੋਚਦੀ ਹਾਂ ਬਟ ਤਾਂ ਵੀ ਮੈਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਮੈਨੂੰ ਚੰਗੇ ਲੱਗਦੇ ਹਾਂ ਉਹਨਾਂ ਦੇ ਸੋਚਣ ਦੀ ਸੋਚਣ ਦਾ ਤਰੀਕਾ ਮੈਨੂੰ ਬੜਾ ਚੰਗਾ ਲੱਗਦਾ ਹੈ ਅਤੇ ਉਹ ਜੋ ਕਰਦੇ ਹਾਂ ਮੈਨੂੰ ਇਦਾਂ ਲੱਗਦਾ ਹੈ ਉਹ ਕਿਤੇ ਨਾ ਕਿਤੇ ਸਾਡੇ ਦੇਸ਼ ਦੇ ਹਿੱਤ ਦੇ ਲਈ ਕਰਦੇ ਹੈ ਅਤੇ ਮੈਨੂੰ ਆਪਣੇ ਦੇਸ਼ ਦੀ ਦੀ ਜੋ ਏਕਤਾ ਹੈ ਉਹ ਉਹ 'ਤੇ ਬਹੁਤ ਜ਼ਿਆਦਾ ਮਾਣ ਹੈ ਅਤੇ ਸਭ ਤੋਂ ਮੈਨੂੰ ਜੋ ਚੀਜ਼ ਚੰਗਾ ਨਹੀਂ ਲੱਗਦਾ ਉਹ ਹੈ ਕਾਨੂੰਨ ਸਾਡੀ ਕਾਨੂੰਨ ਕਾਫੀ ਪਿੱਛੇ ਹੈ ਹੋਰਾਂ ਦੇਸ਼ਾਂ ਤੋਂ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਸਾਨੂੰ ਇਹ ਇਹ ਕਾਨੂੰਨ 'ਤੇ ਹੀ ਕੰਮ ਕਰਨਾ ਚਾਹੀਦਾ ਹੈ ਸਾਡੇ ਲਾਅ ਐਂਡ ਆਰਡਰ 'ਤੇ ਅਤੇ ਮੈਂ ਜਦ ਆਪਣੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤਾਂ ਮਿਲਾਂਗੀ ਤਾਂ ਮੇਰੇ ਮੇਰਾ ਉਹਨਾਂ ਤੋਂ ਇੱਕ ਸਵਾਲ ਹੈ ਕਿ ਤੂੰ ਤੁਸੀਂ ਸਾਡੇ ਦੇਸ਼ ਨੂੰ ਕਿੱਥੇ ਦੇਖਦੇ ਹੋ ਅਤੇ ਸਾਡੇ ਨੌਜਵਾਨਾਂ ਦੇ ਲਈ ਕੀ ਕੀ ਤੁਹਾਡੇ ਤੁਹਾਡੇ ਵੱਲੋਂ ਕੀ ਕੀ ਸੁਝਾਅ ਹਨ ਅਤੇ ਸਾਡਾ ਦੇਸ਼ ਉਹਨਾਂ ਦੇ ਨਿਗਰਾਨੀ ਵਿੱਚ ਕਾਫੀ ਜ਼ਿਆਦਾ ਡੈਵਲਅਪਡ ਹੋ ਰਿਹਾ ਹੈ ਅਤੇ ਕਿਤੇ ਨਾ ਕਿਤੇ ਸਾਡਾ ਪੰਜਾਬ ਵੀ ਹੈ ਜੋ ਕਿ ਕਾਫੀ ਹੱਦ ਤੱਕ ਡੈਵਲਅਪਡ ਹੋ ਚੁੱਕਾ ਹੈ ਅਤੇ ਛੇਤੀ ਹੀ ਮੈਨੂੰ ਲੱਗਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਬੇਰੁਜ਼ਗਾਰੀ ਦੀ ਥਾਂ ਨੌਕਰੀਆਂ ਮਿਲੇਗੀ ਨੌਜਵਾਨਾਂ ਨੂੰ